ਮੈਂ ਅੱਜ ਤੁਹਾਡੇ ਨਾਲ ਆਪਣੀ ਜ਼ਿੰਦਗੀ ਦਾ ਬਹੁਤ ਅਹਿਮ ਪੱਖ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਪਰ ਇਹ ਸ਼ੌਂਕ ਮੈਨੂੰ ਪੈਦਾ ਹੋਇਆ ਮੈਨੂੰ ਆਪਣੀ ਮਾਂ ਦੇ ਕੋਲੋਂ ਕਿ ਸਾਡੀ ਮਾਂ ਬਹੁਤ ਸੋਹਣਾ ਖਾਣਾ ਬਹੁਤ ਸਵਾਦੀ ਖਾਣਾ ਬਣਾਉਂਦੀ ਸੀ ਅਤੇ ਜਿਸ ਕਰਕੇ ਮੈਨੂੰ ਵੀ ਲੱਗਿਆ ਕਿ ਮੈਂ ਵੀ ਆਪਣੀ ਮਾਂ ਦੇ ਵਾਂਗੂੰ ਜਿਸ ਤਰ੍ਹਾਂ ਮੇਰੀ ਮਾਂ ਬਹੁਤ ਸਵਾਦ ਖਾਣਾ ਬਣਾਉਂਦੀ ਸਾਰੇ ਹੀ ਉਹਨਾਂ ਦੇ ਬਣਾਏ ਹੋਏ ਪਰੌਂਠੇ ਜਾਂ ਉਹਨਾਂ ਦੀ ਬਣਾਈ ਹੋਈ ਸਬਜ਼ੀ ਜਦੋਂ ਖਾਂਦੇ ਸੀ ਤਾਂ ਸਾਰੇ ਹੀ ਬੜੀ ਹੀ ਤਾਰੀਫ ਕਰਦੇ ਸੀ ਅਤੇ ਇਸੇ ਤਰ੍ਹਾਂ ਹੀ ਮੈਨੂੰ ਵੀ ਲੱਗਿਆ ਕਿ ਜੇ ਇਹ ਤਾਰੀਫ ਜ਼ਿੰਦਗੀ ਦੇ ਵਿੱਚ ਸਾਨੂੰ ਮਿਲ ਸਕਦੀ ਹੈ ਇਹ ਸਾਰੇ ਜਾਣੇ ਚੰਗਾ ਕਹਿੰਦੇ ਹਨ ਚੰਗੀ ਤਾਰੀਫ ਮਿਲਦੀ ਹੈ ਤਾਂ ਉਹ ਜਰੂ ਚੰਗਾ ਹੈ ਕਿ ਮੈਨੂੰ ਵੀ ਨ ਮਾਂ ਵੱਲ ਵੇਖ ਕੇ ਇਹ ਖਾਣਾ ਬਣਾਉਣ ਦਾ ਜਿਹੜਾ ਮੇਰੇ ਮਨ ਦੇ ਅੰਦਰ ਸ਼ੌਂਕ ਪੈਦਾ ਹੋਇਆ ਕਿ ਜਿਸ ਵਿੱਚ ਮੇਰੀ ਮਾਂ ਨੇ ਕਿ ਹੋਰ ਸਵਾਦੀ ਖਾਣਾ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਮੇਰੀ ਮਾਂ ਨੇ ਮੈਨੂੰ ਦੱਸਿਆ ਅਤੇ ਇਹਦੇ ਵਾਸਤੇ ਮੈਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੋਰ ਚੰਗੇ ਚੰਗੇ ਖਾਣੇ ਬਣਾਉਣ ਵਾਸਤੇ ਜਿਵੇਂ ਸਰਦੀਆਂ ਆਉਂਦੀਆਂ ਹਨ ਅਤੇ ਗਜਰੇਲਾ ਬਣਾਉਣਾ ਜਾਂ ਸਰਦੀਆਂ ਦੇ ਵਿੱਚ ਕੋਈ ਪੰਜੀਰੀ ਵਗੈਰਾ ਬਣਾਉਣੀ ਅਤੇ ਇਸੇ ਤਰ੍ਹਾਂ ਹੀ ਸਮੇਂ ਸਮੇਂ 'ਤੇ ਜਿਹੜੇ ਜਿਵੇਂ ਸਾਗ ਬਣਦਾ ਹੈ ਕਿਸ ਤਰ੍ਹਾਂ ਸਵਾਦੀ ਸਾਗ ਬਣਾਇਆ ਜਾ ਸਕਦਾ ਹੈ ਕਿਹੜੀਆਂ ਕਿਹੜਾ ਸਾਗ ਗੰਦਲਾਂ ਦਾ ਸਾਗ ਵਧੀਆ ਹੁੰਦਾ ਹੈ ਜਾਂ ਸਾਗ ਦੇ ਵਿੱਚ ਕੀ ਪਾਲਕ ਪਾਉਣੀ ਚਾਹੀਦੀ ਹੈ ਜਾਂ ਇਸੇ ਤਰ੍ਹਾਂ ਹੀ ਕਿ ਜਿਵੇਂ ਸਵਾਦੀ ਸਾ ਸਾਗ ਹੋਰ ਵੀ ਕਿਵੇਂ ਸਵਾਦ ਬਣ ਸਕਦਾ ਹੈ